ਹਾਂਜੀ ਮੈਂ ਆਪਣੇ ਫ਼ਲ ਅਤੇ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਇੱਕ ਦੁਸ਼ਹਿਰੀ ਅੰਬ ਦਾ ਬੂਟਾ ਵੀ ਲਾਇਆ ਅਤੇ ਨਿੰਬੂ ਦਾ ਬੂਟਾ ਵੀ ਲਾਇਆ ਹੋਇਆ ਇੱਕ ਬਿੱਲ ਦਾ ਦਰਖਤ ਵੀ ਲਾਇਆ ਹੋਇਆ ਅਤੇ ਅਸੀਂ ਫ਼ਲ ਦਾ ਦੇਖਿਆ ਵੀ ਅੰਬ ਬਹੁਤ ਵਧੀਆ ਅੰਬ ਦਿੰਦਾ ਹਰ ਸਾਲ ਅਤੇ ਜਿਹੜੇ ਨਿੰਬੂ ਹੈ ਉਹ ਬਾਰਾਂ ਮਾਹੀ ਨਿੰਬੂ ਹੈ ਅਸੀਂ ਬਹੁਤ ਵੰਡੀ ਦੇ ਹੈ ਸਾਡਾ ਬੜਾ ਦਿਲ ਖੁਸ਼ ਹੁੰਦਾ ਹੈ ਅਤੇ ਸਬਜ਼ੀਆਂ ਦੇ ਬਾਰੇ ਮੇਰਾ ਇਹੀ ਆ ਵੀ ਘੱਟੋਂ ਘੱਟ ਸਾਨੂੰ ਆਪਣੀ ਰਸੋਈ ਜੋਗੀ ਸਬਜ਼ੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਅਤੇ ਮੈਂ ਜਿਹੜੀ ਹੈ ਮੌਸਮੀ ਸਬਜ਼ੀਆਂ ਹਮੇਸ਼ਾ ਲਾਉਂਦਾ ਹਰੇਕ ਮੌਸਮ 'ਚ ਆਪਣੇ ਘਰ ਜੋਗੀ ਰਸ ਰਸੋਈ ਜੋਗੀ ਸਬਜ਼ੀ ਲਗਾ ਦਿੰਦਾ ਅਤੇ ਸਾਡਾ ਬਹੁਤ ਵਧੀਆ ਉਹਦੇ ਨਾਲ ਐਕਸਪੀਰੀਐਂਸ ਵੀ ਹੁੰਦਾ ਅਤੇ ਸਾਡਾ ਥੋੜ੍ਹਾ ਜਿਹਾ ਖਰਚਾ ਵੀ ਮੇਨਟੇਨ ਹੋ ਜਾਂਦਾ ਕਿਉਂਕਿ ਬਜ਼ਾਰ ਦੀਆਂ ਸਬਜ਼ੀਆਂ ਅਸੀਂ ਦੇਖੀਏ ਤਾਂ ਬਹੁਤ ਜ਼ਿਆਦਾ ਕੈਮੀਕਲ ਯੂਸ ਕੀਤਾ ਹੁੰਦਾ ਅਤੇ ਅਸੀਂ ਆਪਣੀ ਜਿਹੜੀ ਘਰ ਦੇ ਵਿੱਚ ਸਬਜ਼ੀਆਂ ਉਗਾਉਂਦੇ ਹਾਂ ਅਤੇ ਬਗੈਰ ਸਪਰੇਹਾਂ ਅਤੇ ਦੇਸੀ ਖਾਦ ਨਾਲ ਸਬਜ਼ੀਆਂ ਲਾ ਕੇ ਅਸੀਂ ਥੋੜ੍ਹਾ ਜਿਹਾ ਜ਼ਹਰੀਲੇ ਉਸ ਤੋਂ ਬਚ ਸਕਦੇ ਹਾਂ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਘੱਟੋਂ ਘੱਟ ਆਪਣੀ ਰਸੋਈ ਜੋਗੀ ਸਬਜ਼ੀਆਂ ਜ਼ਰੂਰ ਲਾਇਆ ਕਰਨ